ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਜੀ ਬਿਲਕੁਲ ਠੀਕ ਹੈ ਅੱਛਾ ਇਹ ਰਾਤ ਤੋਂ ਹੀ ਹੈ ਜਾਂ ਪਹਿਲਾਂ ਵੀ ਸੀ ਰਾਤ ਦਾ ਹੀ ਕਰਦਾ ਪਿਆ ਵਾ ਕੋਈ ਹੋਰ ਨਾਲ ਕੋਈ ਪ੍ਰੋਬਲਮ ਜਿਵੇਂ ਟੱਟੀਆਂ ਉਲਟੀਆਂ ਅੱਛਾ ਜ਼ਿਆਦਾ ਸਿਰ 'ਚ ਪੀੜ ਹੁੰਦੀ ਹੈ ਜਾਂ ਬੀ ਪੀ ਤਾਂ ਨਹੀਂ ਕਦੇ ਡਾਊਨ ਰਹਿੰਦਾ ਜਾਂ ਜ਼ਿਆਦਾ ਹੋ ਜਾਂਦਾ ਬੀ ਪੀ ਵੱਧਦਾ ਹੀ ਆ ਅਤੇ ਹੁਣ ਸਿਰ ਪੀੜ ਖੰਘ ਜ਼ੁਕਾਮ ਰੇਸ਼ਾ ਹੁੰਦਾ ਜੀ ਕਿ ਨੱਕੋਂ ਪਾਣੀ ਆਉਂਦਾ ਜੇ ਰੇਸ਼ਾ ਤਾਂ ਨਹੀਂ ਆਉਂਦਾ ਬਲਗਮ ਵਗੈਰਾ ਕਿ ਸੁੱਕੀ ਖੰਘ ਆਉਂਦਾ ਜੇ ਸੁੱਕੀ ਖੰਘ ਆਉਂਦੀ ਹੈ ਤਾਂ ਇੱਥੇ ਤੁਸੀਂ ਕਲੀਨਿਕ 'ਤੇ ਨਹੀਂ ਆ ਸਕਦੇ ਜੇ ਮੈਂ ਚਾਰ ਕੁ ਵਜੇ ਤੱਕ ਆ ਜਾਂਦਾ ਜੇ ਕਲੀਨਿਕ 'ਤੇ ਅਤੇ ਨੋਰਮਲ ਹੀ ਘਰੇ ਜੇ ਕੋਈ ਪੈਰਾਸੀਟਾਮੋਲ ਵਗੈਰਾ ਜਾਂ ਕੋਈ ਡਿਸਪਰਿਨ ਵਗੈਰਾ ਗੋਲੀ ਪਈ ਹੈ ਤਾਂ ਲੈ ਲਓ ਜਾਂ ਫਿਰ ਚਾਹ ਕੋਈ ਸੌਂਫ ਅਜਵਾਇਣ ਇਲਾਇਚੀ ਵਗੈਰਾ ਪਾ ਕੇ ਜਿਵੇਂ ਕਾੜ੍ਹਾ ਟਾਈਪ ਨਹੀਂ ਬਣਾਉਂਦੇ ਆਪਾਂ ਘਰਾਂ 'ਚ ਉਹ ਬਣਾ ਕੇ ਥੋੜ੍ਹਾ ਲੈ ਲਓ ਉਸ ਤੋਂ ਬਾਅਦ ਤੁਸੀਂ ਆ ਜਾਓ ਚਾਰ ਵਜੇ ਤੱਕ ਕਲੀਨਿਕ 'ਤੇ ਆ ਜਾਓ ਆਹੋ ਉਹ ਜ਼ਿਆਦਾ ਵਧੀਆ ਰਹੁਗਾ ਨਾ

ਠੀਕ ਹੈ ਜੀ